ਨੇਮਸ ਓਫ ਵਹੀਕਲ ਆਸਟਨ ਮਾਟ੍ਰਨ ਔਡੀ ਬੈਂਟਲੀ ਬੀਐੱਮਡਬਲਯੂ ਵੂਗਾਟੀ ਚੈਵਰਲੈਟ ਫਰਾਰੀ ਫੋਰਸ ਫੋਰਡ ਹੋਂਡਾ ਹੁੰਡਈ ਜੈਗੋਆਰ ਲੈਂਬਰਗਿੰਨੀ ਲੈਂਡ ਰੋਵਰ ਮਹਿੰਦਰਾ ਐਂਡ ਮਹਿੰਦਰਾ ਮਾਰੂਤੀ ਸੁਜੂਕੀ ਮੇਬੈਕ ਮਰਸੀਡੀਜ਼ ਬੈਨਸ ਮਿੰਨੀ ਕੂਪਰ ਮਿਸਟੁਬੂਸ਼ੀ ਨਿਸਾਨ ਸ਼ੈਲਬੀ ਪੋਰਛ ਰਿਨੋਲਟ ਰੋਇਲ ਰਾਇਲਸ ਸਕੌਡਾ ਟੁਇਟਾ ਟਾਟਾ ਵੋਲਕਸਵੈਗਨ ਵੋਲਵੋ